ਮੇਰੇ ਜਾਣਕਾਰ ਨੇ ਵਿਗਿਆਨ ਅਤੇ ਗਣਿਤ ਦਾ ਵਿਸ਼ਾ ਜਿਹੜਾ ਹੈ ਉਹ ਪੜ੍ਹਨ ਲਈ ਕੋਈ ਟਿਊਸ਼ਨ ਨਹੀਂ ਰੱਖੀ ਉਸ ਨੇ ਆਪਣੇ ਆਪ ਆਪਣੇ ਵਿੱਚੋਂ ਐਕਸਪਲੌਰ ਕੀਤਾ ਹੈ ਉਹਨੇ ਉਹਦੇ ਮੁੱਖ ਬਿੰਦੂ ਨੂੰ ਸਮਝਿਆ ਉਹਦੇ ਆਧਾਰਭੂਤ ਗਿਆਨ ਨੂੰ ਸਮਝਿਆ ਅਤੇ ਫਿਰ ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਜਿੰਨੀ ਦੇਰ ਉਹ ਟਿਊਸ਼ਨ ਜਾਂਦਾ ਰਿਹਾ ਜਾਂ ਕੋਸ਼ਿਸ ਕੀਤੀ ਹੈ ਉਹਨੂੰ ਕੁਝ ਨਹੀਂ ਸਮਝ ਆਇਆ ਜਦੋਂ ਉਸ ਨੇ ਆਪਣੇ ਆਪ ਉਹਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਨੇ ਗਣਿਤ ਨੂੰ ਪੜ੍ਹ ਲਿਆ ਇਹ ਕੋਰਸ ਓਨਾ ਔਖਾ ਨਹੀਂ ਜਿੰਨਾ ਸਮਝਿਆ ਜਾਂਦਾ ਹੈ